ਡੇਂਗੂ ਬੁਖਾਰ ਅਤੇ ਮਲੇਰੀਆ ਗਰਮੀਆਂ 'ਚ ਹੋਣ ਵਾਲੀ ਬਿਮਾਰੀ ਹੈ ਇਹ ਬਿਮਾਰੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ ਇਸ ਤੋਂ ਬਚਾਵ ਲਈ ਸਾਨੂੰ ਵੱਖ ਵੱਖ ਉਪਰਾਲੇ ਕਰਨੇ ਚਾਹੀਦੇ ਹਾਂ ਜਿੱਦਾਂ ਕਿ ਸਾਨੂੰ ਪੂਰੇ ਕੱਪੜੇ ਪਹਿਨਣੇ ਚਾਹੀਦੇ ਹਨ ਪੂਰੀ ਬਾਂਹ ਦੀਆਂ ਸ਼ਰਟਾਂ ਪਹਿਨਣੀਆਂ ਚਾਹੀਦੀਆਂ ਹਨ ਫੁੱਲ ਪੈਂਟ ਪਹਿਨਣੀ ਚਾਹੀਦੀ ਹੈ ਸਾਨੂੰ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ ਸਾਨੂੰ ਆਪਣੇ ਪਾਣੀ ਦੀ ਟੈਂਕੀਆਂ ਵਿੱਚ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ ਹੈ ਸਾਨੂੰ ਆਪਣਾ ਕੂਲਰ ਦੀ ਵੀ ਪ੍ਰੋਪਰ ਸਫਾਈ ਕਰਨੀ ਚਾਹੀਦੀ ਹੈ ਤਾਂ ਕਿ ਉੱਥੇ ਪਾਣੀ ਜਮ੍ਹਾਂ ਨਾ ਹੋ ਹੋਵੇ ਜਿਸ ਕਾਰਨ ਮੱਛਰ ਪੈਦਾ ਹੋਣ ਸਾਨੂੰ ਆਪਣੇ ਆਲੇ ਦੁਆਲੇ ਵਾਤਾਵਰਨ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਮੱਛਰ ਨੂੰ ਰੋਕਣ ਲਈ ਮੱਛਰ ਦਾਣੀ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ ਅਤੇ ਆਪਣੇ ਘਰ ਵਿੱਚ ਜਾਲੀ ਵਾਲੇ ਦਰਵਾਜ਼ੇ ਲਗਾਉਣੇ ਚਾਹੀਦੇ ਹਾ ਤਾਂ ਕਿ ਅਸੀਂ ਮੱਛਰਾਂ ਤੋਂ ਬਚਿਆ ਜਾ ਸਕੇ ਸਾਨੂੰ ਮੱਛਰ ਦਾ ਸਪਰੇਅ ਵੀ ਕਰਾਉਣਾ ਚਾਹੀਦਾ ਹੈ ਸਪਰੇਅ ਕਰਾਉਣ ਦੇ ਨਾਲ ਇਹ ਮੱਛਰ ਮਰ ਜਾਂਦਾ ਹੈ ਅਤੇ ਇਹ ਮੱਛਰ ਤੋਂ ਸਾਡਾ ਬਚਾਵ ਹੋ ਸਕਦਾ ਹੈ ਸਾਨੂੰ ਆਪਣੇ ਆਪਣੀ ਸਫਾਈ ਵੀ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਨਿਰੰਤਰ ਇਸ ਮੱਛਰ ਤੋਂ ਬਚਦੇ ਰਹੀਏ ਸਾਨੂੰ ਕਿਸੇ ਵੀ ਆਪਣੇ ਘਰ ਦੇ ਵਿੱਚ ਪਾਣੀ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ ਜਦੋਂ ਪਾਣੀ ਇਕੱਠਾ ਹੋਵੇ ਸਾਨੂੰ ਤੁਰੰਤ ਉਸਨੂੰ ਸਾਫ ਕਰਨਾ ਚਾਹੀਦਾ ਹੈ ਤਾਂ ਕਿ ਇਹ ਮੱਛਰ ਪੈਦਾ ਨਾ ਹੋ ਸਕੇ ਅਤੇ ਸਾਨੂੰ ਵੱਧ ਤੋਂ ਵੱਧ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਮੱਛਰ ਸਾਨੂੰ ਕੱਟ ਨਾ ਸਕੇ ਇਸ ਲਈ ਸਾਨੂੰ ਇਹਨਾਂ ਨੂੰ ਰੋਕਣ ਲਈ ਸਾਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇ ਸਾਨੂੰ ਨਗਰ ਨਿਗਮ ਦੇ ਨਾਲ ਵੀ ਇਹ ਪੂਰਾ ਕਰਨਾ ਚਾਹੀਦਾ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਉਹ ਸਾਡੇ ਗਲੀਆਂ ਮੁਹੱਲਿਆਂ ਵਿੱਚ ਆ ਕੇ ਦਵਾਈ ਦੀ ਸਪਰੇਅ ਮੱਛਰਾਂ ਵਾਲੀ ਦਵਾਈ ਦੀ ਸਪਰੇਅ ਕਰਨ ਅਤੇ ਤਾਂ ਕਿ ਅਸੀਂ ਇਹਨਾਂ ਮੱਛਰਾਂ ਤੋਂ ਸਾਡਾ ਬਚਾਵ ਹੋ ਸਕੇ